ਪਹਿਲਾਂ ਸਮਾਂ ਹੁੰਦਾ ਸੀ ਜਦੋਂ ਬੱਚੇ ਬਾਹਰ ਜਾ ਕੇ ਗਰਾਊਂਡ ਵਿੱਚ ਕਬੱਡੀ ਖੇਡਦੇ ਸੀ ਕੁੜੀਆਂ ਪੀਚੋ ਖੇਡਦੀਆਂ ਸੀ ਅਤੇ ਮੁੰਡੇ ਬੈਟ ਬੌਲ ਖੇਡਦੇ ਸੀ ਕਬੱਡੀ ਖੇਡਦੇ ਸੀ ਹਾਕੀ ਖੇਲਦੇ ਸੀ ਜੰਜ਼ੀਰ ਖੇਲਦੇ ਸੀ ਬੱਚੇ ਸਕੂਲਾਂ ਦੇ ਵਿੱਚ ਛੂਹਣ ਛਣੀਕਾ ਲੁੱਕਣ ਮੀਚੀ ਇਹ ਸਭ ਚੀਜ਼ਾਂ ਖੇਡਾਂ ਖੇਡੇ ਕਰਦੇ ਸੀ ਪਰ ਅੱਜ ਦੇ ਅੱਜ ਕੱਲ੍ਹ ਦੇ ਬੱਚੇ ਘਰਾਂ ਬੈਠੇ ਬੈਠੇ ਲੂਡੋ ਹੋ ਗਈ ਲੂਡੋ ਪੱਬਜੀ ਕੈਂਡੀ ਕਰੱਸ਼ ਅਤੇ ਟੈਂਪਲ ਰੰਨ ਵਰਗੀਆਂ ਸਬਵੇ ਸਫ਼ਰਸ ਟੈਂਪਲ ਰੰਨ ਵਰਗੀਆਂ ਇਹੋ ਜਿਹੀਆਂ ਖੇਡਾਂ ਖੇਡਦੇ ਹਨ ਜੋ ਕਿ ਘਰਾਂ ਬੈਡ ਪਾ ਬੈਠ ਕੇ ਖੇਲੀਆਂ ਜਾਂਦੀਆ ਹਨ ਜਿਹਨਾਂ ਕਰਕੇ ਉਨ੍ਹਾਂ ਦੀ ਸਿਹਤ ਪਾ ਬਹੁਤ ਹੀ ਗੰਦਾ ਪ੍ਰਭਾਵ ਪੈ ਰਿਹਾ ਹਨ ਪਹਿਲੇ ਬੱਚੇ ਹੁੰਦੇ ਸੀ ਜੋ ਬਾਹਰ ਖੇਡਣ ਜਾਂਦੇ ਹੁੰਦੇ ਸੀ ਉਹਨਾਂ ਨੂੰ ਕੱਬਡੀ ਖੇਡਦੇ ਸੀ ਜੋ ਕਿ ਜ਼ੌਰ ਦੀ ਗੇਮ ਹੈ ਉਹ ਬਾਹਰ ਖੇਲਦੇ ਸੀ ਜਿਹਨਾਂ ਨਾਲ ਉਹਦਾ ਸਰੀਰ ਤੰਦਰੁਸਤ ਰਹਿੰਦੇ ਸੀ ਪਰ ਅੱਜ ਕੱਲ੍ਹ ਬੱਚੇ ਕੈਂਡੀ ਕਰੱਸ਼ ਵਰਗੀਆ ਗੇਮਾਂ ਖੇਡਦੇ ਹਨ ਅਤੇ ਜਿਹਨਾਂ ਕਰਕੇ ਇਨ੍ਹਾਂ ਦਾ ਮਾਨਸਿਕ ਸੰਤੁਲਨ ਵੀ ਖਰਾਬ ਹੋ ਚੁੱਕਿਆ ਹੈ